ਮੁੰਡਿਆਂ ਦੀ ਪਹਿਰਾਵੇ ਵਿੱਚ ਮੁੱਖ ਤੌਰ 'ਤੇ ਕੁੜਤਾ ਚਾਦਰ ਪੱਗ ਕੈਂਠਾ ਕਾਂਟੇ ਆਦਿ ਸ਼ਾਮਿਲ ਹਨ ਅਤੇ ਕੁੜੀਆਂ ਦੇ ਪਹਿਰਾਵੇ ਵਿੱਚ ਕਮੀਜ਼ ਸਲਵਾਰ ਦੁਪੱਟਾ ਟਿੱਕਾ ਹਮੇਲ ਗਾਨੀ ਪੀੜਾ ਆਦਿ ਸ਼ਾਮਿਲ ਹਨ ਸਾਡੇ ਅਨੁਸਾਰ ਇਹ ਪੋਸ਼ਾਕਾਂ ਡਾਂਸ ਕਰਨ ਵਾਲਿਆਂ ਨੂੰ ਹੋਰ ਆਕਰਸ਼ਕ ਬਣਾਉਂਦੇ ਹਨ ਕਿਉਂਕਿ ਇਹ ਸਾਡੇ ਸੱਭਿਆਚਾਰ ਦੀ ਝਲਕ ਪੇਸ਼ ਕਰਦੇ ਹਨ